ਪੇਂਡੂ ਖੇਤੀਬਾੜੀ ਵਿੱਚ ਹੁਨਰਮੰਦ ਕਾਮਿਆਂ ਨੂੰ ਲੱਭਣ ਅਤੇ ਕਾਇਮ ਰੱਖਣ ਵਿੱਚ ਚੁਣੌਤੀਆਂ ਜੇਕਰ ਆਪਾਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਤਾਂ ਸਮੇਂ ਦੇ ਨਾਲ ਨਾਲ ਖੇਤੀ ਕਰਨ ਦੇ ਤਰੀਕੇ ਅਤੇ ਖੇਤੀ ਕਰਨ ਵਾਲੇ ਸਾਧਨ ਇਹ ਸਭ ਵਿੱਚ ਬਦਲਾ ਹੋਇਆ ਜਿਵੇਂ ਪਹਿਲਾਂ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਊਠਾਂ ਨਾਲ ਖੇਤੀ ਕੀਤੀ ਜਾਂਦੀ ਸੀ ਅੱਜ ਦੇ ਸਮੇਂ ਵਿੱਚ ਟਰੈਕਟਰ ਆ ਗਏ ਹਨ ਨਾਲ ਹੀ ਪਹਿਲਾਂ ਕਣਕ ਹੱਥ ਹੱਥਾਂ ਰਾਹੀਂ ਵੱਢੀ ਜਾਂਦੀ ਸੀ ਹੁਣ ਜਿਹੜੀ ਕਣਕ ਉਹ ਮਸ਼ੀਨਾਂ ਨਾਲ ਵੱਢੀ ਜਾਂਦੀ ਹੈ ਜੇਕਰ ਆਪਾਂ ਹੁਨਰਮੰਦ ਦੀ ਗੱਲ ਕਰੀਏ ਹੁਨਰਮੰਦ ਕਿਰਤੀ ਇਹ ਆਮ ਇਨਸਾਨ ਨਾਲੋਂ ਵੱਧ ਕੰਮ ਕਰਦੇ ਹਨ ਅਤੇ ਢੰਗ ਤਰੀਕੇ ਨਾਲ ਕੰਮ ਕਰਦੇ ਹਨ ਇਹਨਾਂ ਨੂੰ ਲੱਭਣ ਵਿੱਚ ਅਰਥ ਸ਼ਸਤਰ ਦਾ ਨਿਯਮ ਹੀ ਕੰਮ ਕਰਦਾ ਹੈ ਜਿਵੇਂ ਮੰਗ ਅਤੇ ਪੂਰਤੀ ਕਿਉਂਕਿ ਇਹਨਾਂ ਦੀ ਮੰਗ ਜ਼ਿਆਦਾ ਹੁੰਦੀ ਹੈ ਪਰ ਇਹ ਕਾਮੇ ਗਿਣਤੀ ਵਿੱਚ ਘੱਟ ਹੁੰਦੇ ਹਨ ਜੋ ਹੁਨਰਮੰਦ ਵੀ ਹੁੰਦੇ ਹਨ ਅਤੇ ਨੀਤ ਨਾਲ ਵੀ ਕੰਮ ਕਰਦੇ ਆ ਇਹਨਾਂ ਨੂੰ ਕਾਇਮ ਰੱਖਣ ਦੀਆਂ ਚੁਣੌਤੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਮੰਗ ਜ਼ਿਆਦਾ ਹੋਣ ਦੇ ਨਾਲ ਹਰ ਇੱਕ ਤੱਕ ਇਹਨਾਂ ਦੀ ਪਹੁੰਚ ਨਹੀਂ ਹੁੰਦੀ ਦਿਹਾੜੀਦਾਰ ਕਾਮਿਆਂ ਦੀ ਮੌਜੂਦਾ ਤਨਖਾਹ ਜੇਕਰ ਦਿਹਾੜੀਦਾਰ ਮਜ਼ਦੂਰਾਂ ਦੀ ਮੌਜੂਦਾ ਤਨਖਾਹ ਦੀ ਗੱਲ ਕਰੀਏ ਤਾਂ ਜਿਹੜੀ ਇਹਨਾਂ ਦੀ ਤਨਖਾਹ ਹੈ ਉਹ ਲਗਭਗ ਚਾਰ ਸੌ ਰੁਪਏ ਹੈ ਜਦੋਂ ਕੋਈ ਕੰਮ ਦਾ ਸੀਜ਼ਨ ਆਉਂਦਾ ਜਿਵੇਂ ਕਿ ਹੁਣ ਤੂੜੀ ਬਣਾਉਣ ਦਾ ਸੀਜ਼ਨ ਆਇਆ ਤਾਂ ਇਹ ਤਨਖਾਹ ਵੱਧ ਕੇ ਛੇ ਸੌ ਰੁਪਏ ਜਾਂ ਜਦੋਂ ਨਰਮੇ ਪਟਾਈ ਦਾ ਸੀਜ਼ਨ ਆਵੇਗਾ ਸਪਰੇ ਦਾ ਸੀਜ਼ਨ ਆਵੇਗਾ ਉਸ ਸਮੇਂ ਇਹ ਤਨਖਾਹ ਜਿਹੜੀ ਵੱਧ ਕੇ ਛੇ ਛੇ ਸੌ ਰੁਪਿਆ ਹੋ ਜਾਂਦੀ ਹੈ ਕਿਉਂਕਿ ਉਸ ਸਮੇਂ ਜਿਹੜੇ ਦਿਹਾੜੀਦਾਰ ਉਹ ਘੱਟ ਮਿਲਦੇ ਹੈ ਇਸ ਲਈ ਇਹ ਤਨਖਾਹ ਸਮੇਂ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ